ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਅ ਆਧਾਰ ਕਾਰਡ ਮਾਤਾ ਪਿਤਾ ਦਾ ਆਧਾਰ ਕਾਰਡ ਪਲੱਸ ਜਾਤੀ ਸਰਟੀਫਿਕੇਟ ਇਨਕਮ ਸੋਰਸ ਬੱਚਿਆਂ ਦਾ ਆਧਾਰ ਕਾਰਡ ਲਿੱਤਾ ਜਾਂਦਾ ਹੈ ਜਨਮ ਸਰਟੀਫਿਕੇਟ ਵੀ ਲਿੱਤਾ ਜਾਂਦਾ ਹੈ ਇਹਦੇ ਨਾਲ ਸਰਕਾਰੀ ਸਕੂਲ ਵਿੱਚ ਪੜ੍ਹਾਈ ਬਹੁਤ ਅੱਛੀ ਹੁੰਦੀ ਹੈ ਫਰੀ ਸਿੱਖਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਅੱਜ ਅੱਜ ਕੱਲ੍ਹ ਸਕੂਲ 'ਚ ਐਮੀਨਸ ਬਣੇ ਹੋਏ ਹੈ ਜਿਹਦੇ ਵਿੱਚ ਇੱਕ ਟੈਸਟ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਦੀ ਸਟਡੀ ਬਹੁਤ ਮੁਫ਼ਤ ਹੁੰਦੀ ਹੈ ਉਹਨਾਂ ਨੂੰ ਯੂਨੀਫਾਰਮ ਵੀ ਉੱਥੋਂ ਹੀ ਮਿਲਦੀ ਹੈ ਬੁਕਸ ਵਗੈਰਾ ਸਾਰਾ ਕੁਛ ਫਰੀ ਹੈ ਉਹਨਾਂ ਦੇ ਧੰਨਵਾਦ ਜੀ